ਫਾਜ਼ਿਲਕਾ ਦੇ ਬੈਂਕਾਂ ਵਿੱਚ ਸਟਾਫ ਦੀ ਭਾਰੀ ਕਮੀ ਹੈ ਮੈਂ ਇਹ ਸੁਜੈਸਟ ਕਰਦਾ ਹਾਂ ਕਿ ਬੈਂਕਾਂ ਦੇ ਦਰਵਾਜ਼ੇ ਦੇ ਬਿਲਕੁਲ ਨਾਲ ਹੀ ਰਿਸੈਪਸ਼ਨ ਰਿਸੈਪਸ਼ਨਿਸਟ ਬੈਠੀ ਹੋਵੇ ਅਤੇ ਉਹ ਹਰ ਇੱਕ ਆਉਣ ਜਾਣ ਵਾਲੇ ਦੀ ਮਦਦ ਕਰੇ ਉਹਨੂੰ ਗਾਈਡ ਕਰੇ ਅਤੇ ਜਿਹੜੇ ਡੀਲਿੰਗ ਹੈਂਡ ਨੇ ਉਹ ਪਬਲਿਕ ਨਾਲ ਕਾਫ਼ੀ ਪੋਲਾਈਟ ਰ ਰਹਿਣ ਸਾਡੇ ਸ਼ਹਿਰ ਵਿੱਚ ਕਾਫ਼ੀ ਅਨਪੜ੍ਹਤਾ ਹੈ ਅਤੇ ਜੇ ਹੋ ਸਕੇ ਤਾਂ ਸਟਾਫ਼ ਪੂਰਾ ਕਰਕੇ ਸਾਡੇ ਇਲਾਕੇ ਦੇ ਅਨਪੜ੍ਹ ਲੋਕਾਂ ਦੀ ਵੀ ਮਦਦ ਕੀਤੀ ਜਾਵੇ ਜੇ ਕੋਈ ਗਾਹਕ ਜੋ ਕਿ ਰੱਬ ਦਾ ਰੂਪ ਹੁੰਦਾ ਹੈ ਉਹ ਸੈਟਿਸਫਾਈ ਨਹੀਂ ਤਾਂ ਉੱਥੇ ਇੱਕ ਕੰਪਲੇਂਟ ਸੈੱਲ ਵੀ ਹੋਣੀ ਚਾਹੀਦੀ ਹੈ ਜਿੱਥੇ ਇੱਕ ਸੀਨੀਅਰ ਓਫਿਸਰ ਬੈਠਾ ਹੋਵੇ ਅਤੇ ਉਹ ਉਸ ਮਸਲੇ ਨੂੰ ਚੰਗੀ ਤਰ੍ਹਾਂ ਸੁਣ ਕੇ ਗਾਹਕ ਦੇ ਹੱਕ ਦੀ ਬਣਦੀ ਗੱਲ ਕਰਕੇ ਉਨ੍ਹਾਂ ਨੂੰ ਗਾਹਕ ਨੂੰ ਸੈਟੀਸਫਾਈ ਕਰੇ ਅਤੇ ਜਿਸ ਜਿਸ ਦੇ ਨਾਲ ਬੈਂਕ 'ਤੇ ਚੰਗਾ ਅਸਰ ਪਏਗਾ